ਹਾਂਜੀ ਮੇਰੇ ਹਿਸਾਬ ਨਾਲ ਭੰਗੜਾ ਐਰੋਬਿਕਸ ਨੂੰ ਮਜ਼ੇਦਾਰ ਬਣਾਉਣ ਵਿੱਚ ਸੰਗੀਤ ਬਹੁਤ ਵੱਡਾ ਰੋਲ ਅਦਾ ਕਰਦਾ ਜਦੋਂ ਅਸੀਂ ਭੰਗੜਾ ਕਰਦੇ ਹਾਂ ਤਾਂ ਢੋਲ ਦੀ ਤਾਲ ਤੂੰਬੀ ਦੀ ਮਿੱਠੀ ਆਵਾਜ਼ ਅਤੇ ਐਲਗੈਜੋ ਦੀ ਧੁੰਨ ਸਾਡੇ ਅੰਦਰ ਇੱਕ ਅਲੱਗ ਹੀ ਜੋਸ਼ ਭਰ ਦਿੰਦੀ ਹੈ ਇਹ ਸੰਗੀਤ ਸਿਰਫ਼ ਸੁਣਨ ਵਿੱਚ ਹੀ ਚੰਗੇ ਨਹੀਂ ਲੱਗਦੇ ਬਲਕਿ ਇਹ ਸਾਨੂੰ ਨੱਚਣ ਵੀ ਉਕਸਾਉਂਦੀ ਹੈ ਪੰਜਾਬੀ ਬੋਲ ਲੋਕ ਗੀਤਾਂ ਦੇ ਪੋਪ ਸੰਗੀਤਾਂ ਦਾ ਮਿਸ਼ਰਣ ਭੰਗੜਾ ਐਰੋਬਿਕਸ ਨੂੰ ਹੋਰ ਵੀ ਵਧੀਆ ਬਣਾ ਦਿੰਦਾ ਹੈ ਭੰਗੜਾ ਐਰੋਬਿਕਸ ਵਿੱਚ ਖ਼ਾਸ ਕਰਕੇ ਤੇਜ਼ ਤਾਲ ਵਾਲੇ ਗੀਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਾਡੀ ਕਸਰਤ ਨੂੰ ਹੋਰ ਵੀ ਫ਼ਾਇਦੇਮੰਦ ਬਣਾਉਂਦਾ ਹੈ ਇਹ ਤੇਜ਼ ਤਾਲ ਵਾਲੇ ਗੀਤ ਸਾਡੇ ਦਿਲ ਦੀ ਧੜਕਣ ਨੂੰ ਵਧਾਉਂਦੇ ਜਿਸ ਨਾਲ ਕੈਲੋਰੀਜ ਜਲਦੀ ਬਰਨ ਹੁੰਦੀਆਂ ਹਨ ਅਤੇ ਸਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਇਸ ਤੋਂ ਇਲਾਵਾ ਸੰਗੀਤ ਸਾਡੇ ਮਨ ਨੂੰ ਵੀ ਖੁਸ਼ ਰੱਖਦਾ ਹੈ ਜਿਸ ਨਾਲ ਸਾਨੂੰ ਥਕਾਵਟ ਘੱਟ ਮਹਿਸੂਸ ਹੁੰਦੀ ਹੈ ਅਤੇ ਅਸੀਂ ਜ਼ਿਆਦਾ ਸਮੇਂ ਤੱਕ ਕਸਰਤ ਕਰ ਸਕਦੇ ਹਾਂ ਭੰਗੜਾ ਐਰੋਬਿਕਸ ਵਿੱਚ ਸੰਗੀਤ ਦੀ ਮੌਜੂਦਗੀ ਇਸ ਨੂੰ ਸਿਰਫ਼ ਇੱਕ ਕਸਰਤ ਨਹੀਂ ਬਲਕਿ ਆਪਣੇ ਤਿਉਹਾਰਾਂ ਵਾਂਗ ਵਰਗਾ ਮਾਹੌਲ ਬਣਾ ਦਿੰਦਾ ਹੈ ਜਦੋਂ ਅਸੀਂ ਸੰਗੀਤ ਦੀ ਤਾਲ 'ਤੇ ਨੱਚਦੇ ਹਾਂ ਤਾਂ ਸਾਨੂੰ ਲੱਗਦਾ ਕਿ ਅਸੀਂ ਕਿਸੇ ਖ਼ਾਸ ਮੌਕੇ ਦਾ ਜਸ਼ਨ ਮਨਾ ਰਹੇ ਇਹ ਮ ਮਾਹੌਲ ਸਾਨੂੰ ਤਣਾਅ ਤੋਂ ਦੂਰ ਰੱਖਦਾ ਹੈ ਅਤੇ ਸਾਡੇ ਮਨ ਨੂੰ ਸ਼ਾਂਤ ਕਰਦਾ ਇਸ ਤਰ੍ਹਾਂ ਸੰਗੀਤ ਭੰਗੜਾ ਐਰੋਵਿਕਸ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ ਫ਼ਾਇਦੇਮੰਦ ਬਣਾਉਂਦਾ ਬਲਕਿ ਮਾਨਸਿਕ ਤੌਰ 'ਤੇ ਵੀ ਫ਼ਾਇਦੇਮੰਦ ਬਣਾਉਂਦਾ ਹੈ ਭੰਗੜਾ ਐਰੋਬਿਕਸ ਵਿੱਚ ਸੰਗੀਤ ਦੀ ਮੌਜੂਦਗੀ ਇਸ ਨੂੰ ਪੂਰੀ ਅਤੇ ਮਨੋਰ ਮਨੋਰੰਜਕ ਬਣਾਉਣ ਲਈ ਕਸਰਤ ਬਣਾਉਂਦੀ ਹੈ